ਜੋ ਸਾਡੇ ਕੋਲ ਪਰਿਵਾਰਕ ਪਕਵਾਨ ਹਨ ਜਿਵੇਂ ਕਿ ਸਰੋਂ ਦਾ ਸਾਗ ਹੈ ਮੱਕੀ ਦੀ ਰੋਟੀ ਹੈ ਅਤੇ ਘਰ ਦਾ ਮੱਖਣ ਹੈ ਜੋ ਕਿ ਪੀੜੀ ਦਰ ਪੀੜੀ ਸਾਡੇ ਪਰਿਵਾਰਾਂ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਇਸ ਨੂੰ ਜੋ ਅਸੀਂ ਸਰੋਂ ਤੋਂ ਸਾਗ ਨੂੰ ਤਿਆਰ ਕਰਦ ਕਰਦੇ ਹਾਂ ਇਸ ਵਿੱਚ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗਦਾ ਹੈ